ਸਾਡੀ ਇੱਕ ਆਲੇ ਦੁਆਲੇ ਇੱਕ ਬਹੁਤ ਸੋਹਣੀ ਅਕੈਡਮੀ ਹੈ ਜਿਹਦੇ 'ਤੇ ਮਤਲਬ ਗਰੁੱਪ ਬਹੁਤ ਸਾਰੇ ਗਰੁੱਪ ਬਣੇ ਹੋਏ ਨੇ ਜੋ ਕਿ ਸਾਨੂੰ ਡਾਂਸ ਸਿਖਾਉਂਦੇ ਨੇ ਅਤੇ ਉਹਨਾਂ ਦਾ ਡਾਂਸ ਦੇਖ ਕੇ ਦੂਰੋਂ ਦੂਰੋਂ ਲੋਕ ਗਰੁੱਪ ਬਣਾ ਕੇ ਡਾਂਸ ਸਿਖਣਾ ਆਉਂ ਸਿੱਖਣ ਆਉਂਦੇ ਹਨ ਅਤੇ ਉਹਨਾਂ ਨੇ ਗਰੁੱਪ ਵਿੱਚ ਬਹੁਤ ਸੋਹਣੀ ਡਾਂਸ ਪ੍ਰਦਰਸ਼ਨ ਦੀ ਜਿਹੜੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਹਨ ਬਹੁਤ ਜ਼ਿਆਦਾ ਉ ਉਹਨਾਂ ਨੂੰ ਲੋਕ ਡਾਂਸ ਕਰਦਿਆਂ ਵੇਖ ਕੇ ਲੋਕ ਦੂਰੋਂ ਦੂਰੋਂ ਉਹਨਾਂ ਕੋਲ ਡਾਂਸ ਭੰਗੜਾ ਗਿੱਧਾ ਬੋਲੀਆਂ ਸਿੱਖਣ ਲਈ ਆਉਂਦੇ ਹਨ ਡਾਂਸ ਇੱਕ ਇਹੋ ਜਿਹੀ ਚੀਜ਼ ਹੈ ਕਿ ਹਰ ਕੋਈ ਆਪਣੇ ਪੰਜਾਬ ਵਿੱਚ ਮਹੱਤਵਪੂਰਨ ਰੱਖਦਾ ਹੈ ਭੰਗੜੇ ਨੂੰ ਗਿੱਧੇ ਨੂੰ ਅਤੇ ਇਸ ਕਰਕੇ ਉਹ ਜਿਹੜੀ ਭੂਮਿਕਾ ਬਹੁਤ ਸੋਹਣੀ ਨਿਭਾਉਂਦੇ ਹਨ ਹੋਰਾਂ ਨੂੰ ਵੇ ਵੇਖ ਕੇ ਹੀ ਬੱਚਿਆਂ ਦੇ ਮਨਾਂ ਵਿੱਚ ਵੀ ਭੰਗੜੇ ਦੀ ਜਿਹੜੀ ਭਾਵਨਾ ਹੈ ਉਹ ਮਤਲਬ ਪੈਦਾ ਹੁੰਦੀ ਹੈ ਅਤੇ ਤਾਂ ਹੀ ਬੱਚੇ ਅੱਜ ਕੱਲ੍ਹ ਦੇ ਭੰਗੜਾ ਜਾਂ ਕੋਈ ਹੋਰ ਚੀਜ਼ਾਂ ਨੂੰ ਸਿੱਖਣ ਲਈ ਉਤਸ਼ਾਹਿਤ ਹੁੰਦੇ ਹਨ